ਚਿੱਤਰਕਾਰੀ ਕਰਦੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਕਈ ਕਈਆਂ ਨੂੰ ਤਾਂ ਪੈਨਸਲਾਂ ਵਗੈਰਾ ਜਿਵੇਂ ਕਿ ਕਲਰ ਉਹਨਾਂ ਦਾ ਵੀ ਸਹੀ ਨੋਲੇਜ ਨਹੀਂ ਹੁੰਦੀ ਅਤੇ ਉਹ ਸਹੀ ਤਰ੍ਹਾਂ ਉਹਨਾਂ ਨੂੰ ਨਹੀਂ ਬਣਾ ਸਕਦੇ ਅਤੇ ਇਸ ਇਸ ਨੂੰ ਸ਼ ਬਣਾਉਣ ਲਈ ਇੱਕ ਸਾਫ ਜਗ੍ਹਾ ਅਤੇ ਸ਼ਾਂਤ ਜਗ੍ਹਾ ਚਾਹੀਦੀ ਹੈ ਜਿਸ ਜਿੱਥੇ ਕੋਈ ਵੀ ਨਹੀਂ ਹੋਵੇ ਅਤੇ ਅਸੀਂ ਸਹੀ ਫੋਕਸ ਆਪਣੀ ਡਰਾਇੰਗ 'ਤੇ ਕਰ ਸਕੀਏ ਅਤੇ ਇਸ ਨੂੰ ਇੱਕ ਸਟੈਂਡ ਵੀ ਚਾਹੀਦਾ ਹੈ ਅਤੇ ਪੇਪਰ ਦੀ ਵੀ ਸਹੀ ਨੋਲੇਜ ਹੋਣੀ ਚਾਹੀਦੀ ਹੈ ਜੇ ਕੋਈ ਹਾਰਡ ਪੇਪਰ ਅਤੇ ਕੋਈ ਸੋਫਟ ਪੇਪਰ ਨਾ ਹੋਵੇ